ਹਾਂਜੀ ਸਰ ਮੈਂ ਨਾ ਤੁਹਾਡੀ ਕੰਪਨੀ ਦਾ ਨਾ ਫ਼ੋਨ ਆਰਡਰ ਕੀਤਾ ਸੀ ਠੀਕ ਆ ਤਾਂ ਉਹ ਫ਼ੋਨ ਮੈਨੂੰ ਸਹੀ ਨਹੀਂ ਲੱਗਿਆ ਉਹ ਆਰਡਰ ਮੈਂ ਕੈਂਸਲ ਕਰ ਦਿੱਤਾ ਠੀਕ ਆ ਅਤੇ ਵੀਹ ਦਿਨ ਹੋ ਗਏ ਮੇਰੀ ਜਿਹੜੀ ਆਰਡਰ ਦੀ ਮੈਂ ਪੇਮੈਂਟ ਹੈ ਆਨਲਾਈਨ ਕਰ ਦਿੱਤੀ ਤੀ ਅਤੇ ਉਹ ਮੈਨੂੰ ਵਾਪਿਸ ਨਹੀਂ ਆਈ ਹਜੇ ਤੱਕ ਵੀਹ ਦਿਨ ਹੋ ਗਏ ਸੋ ਤੁਸੀਂ ਮੈਨੂੰ ਦੱਸੋ ਕਿ ਕਦ ਤੱਕ ਮੇਰਾ ਇਸ ਪੇਮੈਂਟ ਦਾ ਹੱਲ ਹੋਉਂਗਾ ਕਦ ਤੱਕ ਮੇਰੀ ਪੇਮੈਂਟ ਮੇਰੇ ਕੋਲ ਆਉਂਗੀ